ਸਤਿ ਸ਼੍ਰੀ ਅਕਾਲ ਜੀ ਹਾਂ ਮੇਰਾ ਇੱਕ ਪ੍ਰੋਜੈਕਟ ਖਰਾਬ ਹੋਇਆ ਹੈ ਬੁਣਾਈ ਅਤੇ ਸਿਲਾਈ ਕਰਦੇ ਸਮੇਂ ਮੈਨੂੰ ਬਹੁਤ ਸਮੱਸਿਆ ਆਈ ਹੈ ਇਸ ਨੂੰ ਇਸ ਨੂੰ ਮੈਂ ਆਪਣੇ ਪਾਪਾ ਜੀ ਦੇ ਅਨੁਭਵ ਨਾਲ ਦੂਰ ਕੀਤਾ ਹੈ ਬੁਣਾਈ ਕਰਦੇ ਸਮੇਂ ਇੱਕ ਤਾਂ ਮੈਂ ਖੱਬੇ ਖੱਬਲ ਖੱਬ ਲੈਫਟ ਹੈਂਡਡ ਹਾਂ ਜਿਹੜਾ ਉਹਦੇ ਕਰਕੇ ਮੈਨੂੰ ਬੁਣਾਈ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸੀ ਪਰ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਬੁਣਾਈ ਸਿੱਖੀ ਬੁਣਾ ਹੱਥ ਨੂੰ ਚਲਾਉਣਾ ਸਿੱਖਿਆ ਤਾਂ ਹੌਲੀ ਹੌਲੀ ਮੇਰੇ ਅਨੁਭਵ ਨਾਲ ਔਰ ਲਗਾਤਾਰ ਟ੍ਰਾਈ ਕਰਦੇ ਕਰਨ ਨਾਲ ਮੈਨੂੰ ਬੁਣਾਈ ਆ ਗਈ ਔਰ ਸਿਲਾਈ ਸ ਪ੍ਰੋਜੈਕਟ ਜਿਹੜਾ ਮੇਰਾ ਖਰਾਬ ਹੋਇਆ ਸੀ ਉਹ ਮੇਰਾ ਬੁਣਾਈ ਦਾ ਪ੍ਰੋਜੈਕਟ ਹੀ ਖਰਾਬ ਹੋਇਆ ਸੀ ਕਿਉਂਕਿ ਮੇਰਾ ਹੱਥ ਨਹੀਂ ਚੱਲਦਾ ਸੀ ਖੱਬਾ ਬੁਣਾਈ ਕਰਦੇ ਸਮੇਂ ਪਰ ਮੈਂ ਜਦੋਂ ਫਿਰ ਦੁਬਾਰਾ ਹੌਲੀ ਹੌਲੀ ਟਰਾਈ ਕੀਤਾ ਤਾਂ ਹੌਲੀ ਹੌਲੀ ਕਰਨ ਨਾਲ ਮੈਨੂੰ ਬੁਣਾਈ ਆ ਗਈ ਔਰ ਔਰ ਸਿਲਾਈ ਕਰ ਸਿਲਾਈ ਸਿੱਖਣ ਸਿੱਖਣ ਲਈ ਮੇਰੇ ਪਾਪਾ ਜੀ ਨੇ ਮੇਰੀ ਬਹੁਤ ਹੈਲਪ ਕੀਤੀ ਆ ਸਿਖ ਸਿਲਾਈ ਸਿਲਾਈ ਕਰਨ ਕਰਨ ਸਮੇਂ ਮੇਰੇ ਪਾਪਾ ਮੈਨੂੰ ਗਾਈਡ ਕਰਦੇ ਸੀ ਵੀ ਇਸ ਤੋਂ ਇੱਥੋਂ ਇਹ ਚੀਜ਼ ਕਰਨੀ ਇੱਥੋਂ ਇਹ ਚੀਜ਼ ਕਰਨੀ ਹੌਲੀ ਹੌਲੀ ਮੈਂ ਬੁਣਾਈ ਸਿੱਖੀ ਅਤੇ ਅਤੇ ਫਿਰ ਮੈਨੂੰ ਬੁਣਾਈ ਕਰਨੀ ਆ ਗਈ ਅਤੇ ਇਸ ਤਰ੍ਹਾਂ ਮੈਂ ਮੇਰੇ ਖੁਦ ਦੇ ਅਨੁਭਵ ਅਤੇ ਆਪਣੇ ਪਾਪਾ ਜੀ ਦੇ ਅਨੁਭਵ ਤੋਂ ਬੁਣਾਈ ਨੂੰ ਸਹੀ ਕੀਤਾ ਬੁਣਾਈ ਨੂੰ ਸਹੀ ਕੀਤਾ ਅਤੇ ਆਪਣੇ ਅਨੁਭਵ ਹ ਤੋਂ ਇਹ ਸਾਰੀਆਂ ਚੀਜ਼ਾਂ ਸਿੱਖੀਆਂ ਇਸ ਕਰਕੇ ਇਸ ਤੋਂ ਬਾਅਦ ਮੈਨੂੰ ਬੁਣਾਈ ਅਤੇ ਸਲ ਸਿਲਾਈ ਸਿਲਾਈ ਕਰਦੇ ਸਮੇਂ ਉਸ ਤੋਂ ਬਾਅਦ ਕੋਈ ਸਮੱਸਿਆ ਨਹੀਂ ਆਈ ਅਤੇ ਇਸ ਤਰ੍ਹਾਂ ਮੈਂ ਆਪਣੇ ਅਨੁਭਵ ਨਾਲ ਨਾਲ ਆਪਣੇ ਅਨੁਭਵ ਨਾਲ ਆਪਣੀ ਸਮੱਸਿਆ ਨੂੰ ਦੂਰ